ਆਧੁਨਿਕ ਸਮੇਂ ਵਿੱਚ ਬਰਤਨ ਧੋਣ ਲਈ ਬਜ਼ਾਰ ਵਿੱਚ ਵੱਖ ਵੱਖ ਪ੍ਰਕਾਰ ਦੇ ਸਾਬਣ ਮਿਲਦੇ ਹਨ ਪੁਰਾਤਨ ਸਮੇਂ ਪਿੰਡਾਂ ਵਿੱਚ ਬਰਤਨਾਂ ਦੀ ਸਫਾਈ ਲਈ ਸਵਾਹ ਦੀ ਵਰਤੋਂ ਕੀਤੀ ਜਾਂਦੀ ਸੀ ਰਸੋਈ ਦੀ ਗੰਦਗੀ ਨੂੰ ਸਾਫ ਕਰਨਾ ਇੱਕ ਔਖਾ ਕੰਮ ਹੈ ਪਰ ਜੋ ਚੀਜ਼ ਇਸਨੂੰ ਹੋਰ ਵੀ ਮੁਸ਼ਕਿਲ ਬਣਾਉਂਦੀ ਹੈ ਉਹ ਹੈ ਚਿਕਨਾਈ ਅਤੇ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨਾ ਕਰਨਾ ਲੂਣ ਨਾ ਸਿਰਫ ਤੁਹਾਡੇ ਭੋਜਨ ਦਾ ਸਵਾਦ ਵਧਾ ਸਕਦਾ ਹੈ ਪਰ ਨਾਲ ਹੀ ਤੁਹਾਡੀ ਰਸੋਈ ਦੀ ਗੰਦਗੀ ਨੂੰ ਵੀ ਸਾਫ ਕਰ ਸਕਦਾ ਹੈ ਚਿਕਨਾਈ ਅਤੇ ਤੇਲ ਵਾਲੇ ਬਰਤਨਾਂ ਨੂੰ ਗਰਮ ਪਾਣੀ ਵਿੱਚ ਚੰਗੀ ਮਾਤਰਾ ਵਿੱਚ ਨਮਕ ਪਾ ਕੇ ਇੱਕ ਘੰਟੇ ਲਈ ਭਿਓਂ ਕੇ ਰੱਖੋ ਅਤੇ ਫਿਰ ਚੰਗੀ ਤਰ੍ਹਾਂ ਕੂਚੀ ਦੀ ਵਰਤੋਂ ਕਰਕੇ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ ਬਰਤਨਾਂ ਨੂੰ ਸਾਫ ਕਰਨ ਦਾ ਇੱਕ ਹੋਰ ਤਰੀਕਾ ਹੈ ਰਗੜਨ ਵਾਲੀ ਐਲਕੋਹਲ ਜਾਂ ਡਿ ਡਿਟਰਜੈਂਟ ਨੂੰ ਲੂਣ ਦੇ ਨਾਲ ਮਿਲਾਉਣ ਮਿਲਾਉਣਾ ਇਸ ਲਈ ਮਿਸ਼ਰਣ ਨੂੰ ਬਰਤਨਾਂ ਉੱਤੇ ਫੈਲਾਉਣਾ ਅਤੇ ਤੀਹ ਮਿੰਟ ਬਾਅਦ ਗਰਮ ਗਰਮ ਪਾਣੀ ਨਾਲ ਸਾਫ ਕਰਨਾ ਹੈ ਅਤੇ ਇਹਨਾਂ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਤੇਲ ਵਾਲੇ ਬਰਤਨ ਸਾਫ ਕਰਨ ਲਈ ਰੇਤ ਅਤੇ ਲੱਸੀ ਅਤੇ ਨਿੰਬੂ ਆਦਿ ਜਿਹੇ ਪੁਰਾਣੇ ਤਰੀਕੇ ਵੀ ਵਰਤੇ ਜਾਂਦੇ ਹਨ